ਮੈਨੂੰ ਮੱਛੀਆਂ ਤਾਂ ਬਹੁਤ ਪਸੰਦ ਹਨ ਜਦੋਂ ਉਹ ਪਾਣੀ 'ਚ ਤੈਰਦੀਆਂ ਹਨ ਤਾਂ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ ਜਦ ਕਿ ਪਰ ਮੈਨੂੰ ਇਹ ਖਾਣਾ ਪਸੰਦ ਨਹੀਂ ਹੈ ਮੱਛੀਆਂ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਹਾਂ ਤਾਂ ਉੱਥੇ ਪਾਣੀ ਸਰੋਵਰ ਦੇ ਵਿੱਚ ਬਹੁਤ ਸੋਹਣੀਆਂ ਲੱਗਦੀਆਂ ਹਨ ਇਹ ਕਈ ਰੰਗਾਂ ਦੀਆਂ ਹੁੰਦੀਆਂ ਹਨ ਜਿੱਦਾਂ ਸੰਤਰੀ ਰੰਗ ਦੀ ਹੁੰਦੀ ਹੈ ਕੋਈ ਸਿਲਵਰ ਕਲਰ ਦੀ ਹੁੰਦੀ ਹੈ ਉਹ ਬਹੁਤ ਅੱਛੀਆਂ ਲੱਗਦੀਆਂ ਉੱਥੇ ਪਾਣੀ ਦੇ ਵਿੱਚ ਤੈਰਦੀਆਂ ਪਰ ਮੈਂ ਖਾਂਦੀ ਨਹੀਂ ਹਾਂ ਕਿਉਂਕਿ ਅਸੀਂ ਵੈਸ਼ਨੋ ਹਨ ਇਹ ਵਾਲੇ ਮੱਛੀਆਂ ਵਗੈਰਾ ਨਹੀਂ ਖਾਂਦੇ ਪਰ ਮੈਨੂੰ ਕੁਛ ਮੱਛੀਆਂ ਦੇ ਨਾਮ ਪਤਾ ਹਨ ਜਿਵੇਂ ਬਟਰਫਲਾਈ ਬੋਨੀ ਫਿਸ਼ ਪਿੱਗ ਫੇਸ ਬੀਮ ਲੌਂਗ ਸਪੰਜ ਵੀਮ ਇਹ ਫਿਸ਼ ਹਨ ਜੋ ਮੈਨੂੰ ਸੋਹਣੀਆਂ ਲੱਗਦੀਆਂ ਹਨ ਪਰ ਮੈਂ ਕਦੀ ਅੱਜ ਤੱਕ ਖਾਧੀ ਨਹੀਂ ਪਰ ਦੇਖਣ ਨੂੰ ਬਹੁਤ ਸੋਹਣੀਆਂ ਲੱਗਦੀਆਂ ਹਨ ਜਿਹੜੀਆਂ ਕਿ ਮੈਨੂੰ ਪਸੰਦ ਹਨ ਇਹ ਮੱਛੀਆਂ